ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਡ ਈਵਨਿੰਗ ਜੀ ਗੁਡ ਈਵਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਿਬਰਾ ਸਰਵਿਸ ਤੋਂ ਬੋਲ ਰਿਹਾ ਜੀ ਦੱਸੋ ਮੈਮ ਕੀ ਹੈਲਪ ਕਰ ਸਕਦਾ ਤੁਹਾਡੀ ਠੀਕ ਹੈ ਜੀ ਹਮ ਹਮ ਹਮ ਮੈਂ ਦੱਸ ਦਿੰਦਾ ਜੀ ਤੁਹਾਨੂੰ ਸਾਰਾ ਲਿਬਰਾ ਆਪਣਾ ਸੋਰੀ ਵੋਲਵੋ ਦਾ ਦੇਖੋ ਜੀ ਅਸੀਂ ਸਾਰੀ ਸਾਰੀ ਚੀਜ਼ਾਂ ਡੀਲ ਕਰਦੇ ਹਾਂ ਵੋਲਵੋ ਵੀ ਆਪਣੇ ਕੋਲ ਹੈ ਲੋਕਲ ਵੀ ਹੈਗੀਆਂ ਨੇ ਅਤੇ ਵੋਲਵੋ ਦੀ ਗੱਲ ਕਰੀਏ ਕਿ ਮੇਜਰ ਸਿਟੀ ਜਿਹੜਆਂ ਕਾਊਂਟ ਕਰਦੇ ਆ ਜਿੱਦਾ ਸਟਾਟਿੰਗ ਲੁਧਿਆਣਾ ਤੋਂ ਆ ਸਾਡਾ ਮੇਨ ਔਫਿਸ ਜਿਹੜਾ ਹੈਗਾ ਹੈ ਬੱਸ ਸਟੈਂਡ ਦੇ ਕੋਲ ਹੈਗਾ ਜੀ ਨਾਲ ਨਾ ਦੁੱਗਰੀ ਸਾਈਡ ਵੀ ਸਾਡਾ ਮੇਨ ਔਫਿਸ ਹੈਗਾ ਇਹ ਸਾਡੇ ਦੀ ਸਾਰੀ ਹਾਂਜੀ ਰਾਤੀ ਵੀ ਚੱਲਦੀਆਂ ਬੱਸਾਂ ਸਵੇਰੇ ਵੀ ਚੱਲਦੀਆਂ ਨੇ ਅਰਲੀ ਮੋਰਨਿੰਗ ਸਾਡਾ ਸ਼ਡਿਊਲ ਹੋ ਜਾਂਦਾ ਸਾਡਾ ਟਾਈਮ ਸ਼ੁਰੂ ਹੁੰਦਾ ਜੀ ਸੱਤ ਵਜੇ ਛੇ ਵਜੇ ਤੋਂ ਛੇ ਤੋਂ ਚਲਦੀ ਆ ਜੀ ਹਾਂਜੀ ਛੇ ਸੱਤ ਅੱਠ ਨੌਂ ਇਹ ਟਾਈਮਿੰਗ ਹੁੰਦੀਆਂ ਸ਼ਾਮੀ ਟਾਈਮਿੰਗ ਚੱਲਦੀਆਂ ਸਾਡੀਆਂ ਆਪਣਾ ਦਸ ਗਿਆਰ੍ਹਾਂ ਬਾਰ੍ਹਾਂ ਤੋਂ ਠੀਕ ਆ ਜੀ ਅਤੇ ਇਹ ਚੱਲਦੀਆਂ ਬਿਲਕੁਲ ਅਤੇ ਤੁਸੀਂ ਦੁਪਹਿਰੀ ਜਾਣਾ ਅਤੇ ਇੱਕ ਬੱਸ ਚਲਦੀ ਆ ਜੀ ਇੱਕ ਵਜੇ ਤੋਂ ਇਹ ਮੇਜਰ ਸਿਟੀਆਂ ਜਿਹੜੀਆਂ ਕਾਉਂਟ ਕਰਦੀਆਂ ਨੇ ਉਹ ਹੈਗੇ ਚੰਡੀਗੜ੍ਹ ਚੱਲਦੀ ਹੈ ਜੀ ਇੱਧਰੋਂ ਠੀਕ ਹੈ ਜੀ ਮੇਨ ਚੰਡੀਗੜ੍ਹ ਹੁੰਦੇ ਹੋਏ ਆਪਣਾ ਦਿੱਲੀ ਮੇਜਰ ਚਲਦੀ ਹੈ ਜੀ ਦਿੱਲੀ ਜਾ ਸਕਦੇ ਹੋ ਤੁਸੀਂ ਮੇਨ ਮੇਨ ਸਿਟੀਜ ਲਖਨਊ ਜਾਂਦੀ ਹੈ ਜੀ ਇੱਧਰੋਂ ਡਾਇਰੈਕਟ ਅਤੇ ਅਤੇ ਆਪਣਾ ਕਹਿ ਸਕਦੇ ਹਾਂ ਅਸੀਂ ਜੋ ਵੀ ਨੀਅਰ ਪੰਜਾਬ ਪਲੇਸਿਸ ਦੇ ਉਦੋਂ ਜਾ ਹੀ ਰਹੀਆਂ ਨੇ ਪਰ ਜਿਹੜੀ ਮੇਜਰ ਨੇ ਉਹ ਦਿੱਲੀ ਹੋ ਗਈ ਆਪਣਾ ਲਖਨਊ ਹੋ ਗਿਆ ਹੈ ਨਾ ਅੱਜ ਕੱਲ੍ਹ ਜ਼ਿਆਦਾਤਰ ਵੋਲਵੋ ਜਾ ਰਹੀਆਂ ਨੇ ਉੱਥੇ ਯੂਪੀ ਸਾਈਡ ਬਹੁਤ ਜਾ ਰਹੀਆਂ ਵੀ ਕੋਈ ਅੱਜ ਕੱਲ੍ਹ ਪਤਾ ਸਾਨੂੰ ਬਿਲਕੁਲ ਬਿਲਕੁਲ ਉੱਥੇ ਵੀ ਜਾ ਸਕਦੇ ਜੀ ਬਿਲਕੁਲ ਦਿੱਲੀ ਕੋਲੋਂ ਜਾਂਦੀ ਹੈ ਜੀ ਹਮ

ਬਿਲਕੁਲ ਜੀ ਬਿਲਕੁਲ ਜਾਂਦੀ ਆ ਉਹ ਲੰਬਾ ਸਫਰ ਹੁੰਦਾ ਆ ਜੀ ਰਾਜਸਥਾਨ ਦਾ ਅਤੇ ਇੱਦਾ ਨਹੀਂ ਵਿਚਕਾਰ ਇੱਕ ਸਟੋਪ ਰਹਿੰਦਾ ਸਟੇਅ ਥੋੜ੍ਹਾ ਰਹਿੰਦਾ ਅਤੇ ਉਹ ਦਿੱਲੀ ਮੇਨ ਰਹਿੰਦਾ ਜੀ ਦਿੱਲੀ ਉਹ ਹੁੰਦੇ ਜੀ ਸਿੱਧੇ ਮੇਨ ਚਲ ਜਾਂਦੀ ਜੀ ਰਾਜਸਥਾਨ ਦੀ ਅਤੇ ਮੇਨ ਤਾਂ ਤੁਹਾਡਾ ਸਟੇਅ ਰਹੇਗਾ ਜੀ ਸ਼ਡਿਊਲ ਰਹਿੰਦਾ ਜੀ ਫੈਸਲਿਟੀ ਤੁਹਾਨੂੰ ਸਾਰੀ ਅਵੇਲੇਬਲ ਹੋਣਗੀਆਂ ਜੀ ਇਹਦੇ ਅੰਦਰ ਅਤੇ ਬੈਸਟ ਫੇਅਰ ਮਿਲੇਗਾ ਜੀ ਇਹਦਾ ਅਤੇ ਮਤਲਬ ਆਲਮੋਸਟ ਤੁਹਾਨੂੰ ਜਿਹੜੀ ਜਿਹੜੀ ਸਿਟੀ ਘੁੰਮਣਾ ਚਾਹੁੰਦੇ ਹੋ ਉਹ ਮੈਨੂੰ ਦੱਸ ਦੋ ਦੇਖੋ ਇੱਕ ਵੋਲਵੋ ਹੁੰਦੀ ਹੈ ਸਿੰਪਲ ਟੂਰਿਸਟ ਨੂੰ ਲੈ ਕੇ ਜਾਂਦੀ ਹੈ ਤੁਸੀਂ ਅਗਰ ਜਿੱਦਾਂ ਸੋਚ ਰਹੇ ਹੋ ਕਿ ਪੂਰਾ ਪ੍ਰੋਪਰਲੀ ਹਜੇ ਕਵਰ ਕਰੀਏ ਅਤੇ ਉਹ ਹੋ ਜਾਏਗਾ ਕਵਰ ਕੋਈ ਇੱਦਾਂ ਦੀ ਪਰੇਸ਼ਾਨੀ ਨਹੀਂ ਹੈ ਡਰਾਈਵਰ ਬੱਸਾਂ ਚੇਂਜ ਕਰਨੀਆਂ ਪੈਣਗੀਆਂ ਇੱਕ ਦੋ ਤੁਹਾਨੂੰ ਕਿਉਂਕਿ ਸਿਟੀ ਓ ਸਿਟੀ ਵਾਈਜ਼ ਅਲੱਗ ਅਲੱਗ ਬੱਸਾਂ ਹੋਣਗੀਆਂ ਸਾਰੀ ਮੇਨ ਇੱਕ ਤੁਹਾਨੂੰ ਕੋਨੈਕਟ ਕਰਦੀ ਨਹੀਂ ਜਾਣਗੀਆਂ ਹਾਂਜੀ ਮੈਮ ਦੇਖੋ ਵੋਲਵੋ ਇੱਕ ਬ੍ਰਾਂਡ ਐ ਨਾ ਬਹੁਤ ਵੱਡਾ ਨਾਮ ਹੈ ਜੀ ਸਾਨੂੰ ਸਾਰੀ ਹੀ ਫੈਸਲਿਟੀ ਤੁਹਾਨੂੰ ਇੱਕ ਇੱਕ ਚੀਜ਼ ਮਿਲੇਗੀ ਜੋ ਤੁਸੀਂ ਲਗਜ਼ਰੀ ਬੱਸ 'ਚ ਕਾਊਂਟ ਕਰਦੇ ਹੋ ਉਹ ਚੀਜ਼ਾਂ ਸਾਨੂੰ ਇਸ ਬੱਸ ਦੇ ਅੰਦਰ ਮਿਲਣਗੀਆਂ ਸਾਰੀਆਂ ਵਿਦ ਬੈਸਟ ਪਰਾਈਜ ਕੋਸਟ ਦੇ ਅੰਦਰ ਦੇਖੋ ਜੀ ਦਿੱਲੀ ਤਾਂ ਜਾਂਦੇ ਹੋ ਜ਼ਿਆਦਾਤਰ ਸਾਡੇ ਕੋਲ ਜਿਹੜੇ ਟੂਰਿਸਟ ਆਉਂਦੇ ਨੇ ਦਿੱਲੀ ਦੇ ਜਾਂਦੇ ਨੇ ਦਿੱਲੀ ਤੋਂ ਬਾਅਦ ਬੱਸ ਵੋਲਵੋ ਅੱਗੇ ਮੇਜਰ ਰੂਟ 'ਤੇ ਚੱਲ ਜਾਂਦੀਆਂ ਨੇ ਜਿੱਦਾਂ ਯੂਪੀ ਸਾਈਡ ਰਾਜਸਥਾਨ ਸਾਈਡ ਦਿੱਲੀ ਮੇਨ ਮੈਟਰੋ ਸਿਟੀ 'ਚ ਕਾਊਂਟ ਕਰ ਲੈਂਦੇ ਹਾਂ ਉਧਰੋਂ ਸਾਰੇ ਡਾਇਵਰਟ ਹੋ ਜਾਂਦੀਆਂ ਸਾਰੀ ਬੱਸਾਂ ਜਿਹੜੀਆਂ ਵੋਲਵੋ ਬਸ ਜਾਂ ਰੂਟ ਨੇ ਉਹ ਦਿੱਲੀ ਤੋਂ ਅੱਗੇ ਕਰਵਾਉਂਦੀ ਦਿੱਲੀ ਤੱਕ ਦੇ ਫਿਰ ਤੁਹਾਡਾ ਜਾਂਦਾ ਬਾਰ੍ਹਾਂ ਸੌ ਰੁਪਏ ਉਹਦੇ ਬਾਅਦ ਤੁਸੀਂ ਅੱਗੇ ਰਾਜਸਥਾਨ ਚਲੇ ਜਾਂਦੇ ਹੋ ਹਾਂਜੀ ਇੱਕ ਪਰਸਨ ਦੇ ਬਾਰ੍ਹਾਂ ਸੌ ਤੋਂ ਲੈ ਕੇ ਦੋ ਹਜ਼ਾਰ ਤੱਕ ਕੋਲ ਜਾਂਦੀ ਹੈ ਡਿਪੈਂਡ ਟੂ ਫੈਸਿਲਿਟੀਜ਼ ਵਾਈਜ਼ ਹੈ ਨਾ ਜਿੱਦਾ ਬਿਜਨਸ ਕਲਾਸ ਲੈ ਰਹੇ ਹੋ ਜਾਂ ਇਕਨੋਮਿਕ ਕਲਾਸ ਲੈ ਰਹੇ ਹੋ ਤੁਸੀਂ ਅੰਦਰ ਵੀ ਅਕਾਊਂਟ ਹੁੰਦੀਆਂ ਨੇ ਇਹਦੇ ਅੰਦਰ ਵੀ ਥੋੜ੍ਹੇ ਸਲਿੱਪਰ ਕਲਾਸ ਲੈ ਰਹੇ ਜਿੱਦਾਂ ਅਸੀਂ ਕਹਿ ਰਹੇ ਹੋ ਹੈ ਨਾ ਸਿਟਿੰਗ ਕਲਾਸ ਲੈ ਰਹੇ ਹੋ ਇੱਦਾਂ ਹੀ ਤੁਸੀਂ ਕਹਿ ਸਕਦੇ ਹੋ ਅਤੇ ਉਹਦੇ ਬਾਅਦ ਤੁਹਾਡਾ ਰਾਜਸਥਾਨੀ ਜਿਹੜਾ ਉੱਧਰੋਂ ਕਰ ਕਰ ਲਈਏ ਤਾਂ ਤੁਹਾਡਾ ਮੇਨ ਨੀਅਰ ਅਬਾਊਟ ਦੋ ਢਾਈ ਦਾ ਉੱਥੋ ਚੱਲ ਜਾਂਦਾ ਹਾਂਜੀ ਹਾਂਜੀ ਇੰਨਾਂ ਕੋਸਟ ਪੈ ਜਾਂਦੀ ਜੀ ਤੁਹਾਨੂੰ ਬਿਲਕੁਲ ਹਾਂਜੀ ਹਾਂਜੀ ਬਾਕੀ ਜੋ ਤੁਹਾਨੂੰ ਮੈਂ ਤੁਹਾਨੂੰ ਸਾਨੂੰ ਸੇਵਾ ਦਾ ਮੌਕਾ ਦਿਓ ਅਤੇ ਤੁਸੀਂ ਮੈਨੂੰ ਨੰਬਰ ਮੇਰੇ ਕੋਲ ਆ ਹੀ ਗਿਆ ਤੁਸੀਂ ਮੈਨੂੰ ਕੰਨੈਕਟ ਕਰਕੇ ਨਾ ਕੱਲ੍ਹ ਮੈਨੂੰ ਮਿਲੋ ਆਫਿਸ 'ਚ ਅਤੇ ਬੁਕਿੰਗ ਕਰ ਲੈਂਦੇ ਆ ਠੀਕ ਹੈ ਜੀ ਨਹੀਂ ਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਵੈਲਕਮ ਜੀ ਵੈਲਕਮ